ਜੀ ਹਾਂ ਮੈਂ ਸ਼ੋਸ਼ਲ ਮੀਡੀਆ 'ਤੇ ਡਾਂਸ ਰੀਲਾਂ ਅਤੇ ਸ਼ੌਟਸ ਦੇਖਦੀ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਕਿਸੇ ਕੋਲੋਂ ਵੀ ਇੰਨਾਂ ਸਮਾਂ ਨਹੀਂ ਹੈਗਾ ਕਿ ਆਪਾਂ ਲੰਬੀਆਂ ਲੰਬੀਆਂ ਵੀਡੀਓਸ ਜਾਂ ਲੰਬੇ ਲੰਬੇ ਵਲੋਗਸ ਦੇਖ ਸਕੀਏ ਸੁਖ ਰੀਲਾਂ ਅਤੇ ਸ਼ੌਟਸ ਜਿਹੜੇ ਆ ਇਹ ਇੱਕ ਇੱਕ ਦੋ ਦੋ ਮਿੰਟ ਦੇ ਹੁੰਦੇ ਜਿਹਦੇ ਨਾਲ ਕੀ ਹੁੰਦਾ ਏ ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਆਪਾਂ ਨੂੰ ਬਹੁਤ ਸਾਰਾ ਕੰਟੈਂਟ ਜਿਹੜਾ ਏ ਵੇਖਣ ਨੂੰ ਮਿਲਦਾ ਬੜੀਆਂ ਵਧੀਆ ਵਧੀਆ ਰੀਲਾਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਐਂ ਮੈਂ ਜ਼ਿਆਦਾਤਰ ਗਿੱਧੇ ਜਾਂ ਭੰਗੜੇ ਦੀਆਂ ਵੀਡੀਓਜ਼ ਦੇਖਣਾ ਪਸੰਦ ਕਰਦੀ ਹਾਂ ਵੈਸੇ ਤਾਂ ਮੇਰੇ ਬਹੁਤ ਸਾਰੇ ਪਸੰਦੀਦਾ ਡਾਂਸਸ ਜਿਹੜੇ ਨੇ ਉਹ ਹੈਗੇ ਨੇ ਪਰ ਸ਼ੋਸ਼ਲ ਮੀਡੀਆ 'ਤੇ ਮੈਨੂੰ ਸਭ ਤੋਂ ਜ਼ਿਆਦਾ ਨੂਰ ਜ਼ੋਰਾ ਦੀਆਂ ਵੀਡੀਓਜ਼ ਵੇਖਣਾ ਪਸੰਦ ਏ ਇਹ ਆਪਣੇ ਸੱਭਿਆਚਾਰ ਨਾਲ ਰਿਲੇਟਡ ਡਾਂਸ ਵੀਡੀਓਜ਼ ਬਣਾਉਂਦੇ ਨੇ ਫਿਰ ਜੇ ਕਿਸੇ ਫੰਕਸ਼ਨ ਦੇ ਉੱਤੇ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਹੋਵੇ ਤਾਂ ਉੱਥੋਂ ਦੀਆਂ ਵੀਡੀਓਜ਼ ਵੀ ਅਪਲੋਡ ਕਰਦੇ ਨੇ